ਹਾਂਜੀ ਹਾਂਜੀ ਅਸੀਂ ਤਿਉਹਾਰ ਬਹੁਤ ਵਧੀਆ ਮਨਾਉਂਦੇ ਹਾਂ ਜਿੱਦਾਂ ਦੀਵਾਲੀ ਹੁੰਦੀ ਆ ਦੁਸਹਿਰਾ ਹੁੰਦਾ ਜਾਂ ਕੁਛ ਆ ਜਿੱਦਾਂ ਸਾਡੇ ਕੋਲ ਹੈਗੇ ਨੇ ਸਰਦਾਰ ਵੀ ਹੈਗੇ ਨੇ ਮੁਸਲਮਾਨ ਵੀ ਹੈਗੇ ਨੇ ਜੈਨੀਆਂ ਵੀ ਹੈਗੇ ਨੇ ਸਾਰੇ ਅਸੀਂ ਰਲ ਮਿਲ ਕੇ ਤਿਉਹਾਰ ਮਨਾਉਂਦੇ ਰਹਿੰਦੇ ਹਾਂ ਜਿੱਦਾਂ ਹੁਣ ਅਸੀਂ ਦੁਸਹਿਰੇ ਦੇ ਆ ਅਸੀਂ ਇਕੱਠੇ ਚੱਲ ਜਾਂਦੇ ਹਾਂ ਉਧਰੋਂ ਸਰਦਾਰ ਭਾਈ ਸੀ ਉਹਨਾਂ ਨਾਲ ਲੈ ਆਨੇ ਆ ਅਸੀਂ ਇੱਧਰੋਂ ਮੁਸਲਮਾਨਾਂ ਨੂੰ ਵੀ ਨਾਲ ਲੈ ਆਨੇ ਆ ਅਸੀਂ ਰਲ ਮਿਲ ਕੇ ਤਿਉਹਾਰ ਮਨਾ ਲਈਦੇ ਆ ਉਧਰੋਂ ਹੋਲੀ 'ਤੇ ਵੀ ਅਸੀਂ ਐਦੀ ਕਰੀਦਾ ਵਾ ਇੱਕ ਦੂਜੇ ਨੂੰ ਅਸੀਂ ਰੰਗ ਲਾਂਨੇ ਆ ਅਸੀਂ ਅਸੀਂ ਵੀ ਰੰਗ ਲਾਂਨੇ ਉਹ ਵੀ ਰੰਗ ਲਾਂਦੇ ਆ ਬਹੁਤ ਵਧੀਆ ਜਿੱਦਾਂ ਮਰਜ਼ੀ ਪਤਾ ਕੀ ਗੱਲ ਆ ਰੱਬ ਤਾਂ ਇੱਕੋ ਹੀ ਆ ਇਹ ਜਿੱਦਾਂ ਮਰਜ਼ੀ ਹੋਣ ਰਸਤੇ ਤਾਂ ਅਲੱਗ ਅਲੱਗ ਆ ਵੀ ਉ ਉੱਧਰ ਰਸਤਾ ਕੋਈ ਉੱਧਰ ਰਖਾ ਉੱਧਰ ਰਸਤਾ ਪਰ ਜਗ੍ਹਾ ਤਾਂ ਇੱਕੋ ਹੀ ਆ ਨਾ ਇੱਕੋ ਹੀ ਜਗ੍ਹਾ 'ਤੇ ਜਾ ਕੇ ਮਿਲਣਾ ਆ ਉੱਥੇ ਜਾ ਕੇ ਮਿਲਣਾ ਹਾਂਜੀ ਠੀਕ